ਨੌਜਵਾਨ ਪੀੜ੍ਹੀ ਵੀ ਸੱਭਿਆਚਾਰਕ ਰੀਤਾਂ ਆਦਿ ਦੀ ਪਾਲਣਾ ਕਰਦੀ ਹੈ ਪਰ ਉਹ ਬਹੁਤ ਹੀ ਜ਼ਿਆਦਾ ਸਖਤ ਤਰੀਕੇ ਨਾਲ਼ ਨਹੀਂ ਕਰਦੀ ਉਹ ਕੁਝ ਰਸਮਾਂ ਰੀਤਾਂ ਨੂੰ ਮੰਨਦੀ ਹੈ ਅਤੇ ਕੁਝ ਨੂੰ ਨਹੀਂ ਮੰਨਦੀ ਜਿਵੇਂ ਕਿ ਹੁਣ ਕਈ ਤਿਉਹਾਰਾਂ 'ਤੇ ਇੱਕ ਪੈ ਪੁਰਾਣੀ ਰਿਵਾ ਰਸਮ ਰੀਤ ਸੀ ਕਿ ਹ ਹਰ ਥਾਂ ਮੱਥਾ ਟੇਕਣਾ ਹੁੰਦਾ ਸੀ ਅਤੇ ਹੁਣ ਜੋ ਨੌ ਨੌਜਵਾਨ ਪੀੜ੍ਹੀ ਹੈ ਉਹ ਕਿਤੇ ਮੱਥਾ ਟੇਕਦੀ ਹੈ ਅਤੇ ਕਿਤੇ ਨਹੀਂ ਟੇਕਦੀ ਪਹਿਲਾਂ ਪੁਰਾਣੀ ਪੀੜ੍ਹੀ ਕੁੜਤੇ ਚਾਦਰੇ ਪਾਉਂਦੀ ਸੀ ਤਾਂ ਉਹਨਾਂ ਦੀ ਸ਼ੋਭਾ ਵੱਧਦੀ ਸੀ ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਸਮਝਦੀ ਹੈ ਕਿ ਇਹ ਸਭ ਚੀਜ਼ਾਂ ਕੁੜਤਾ ਚਾਦਰਾ ਪਾਉਣ ਨਾਲ਼ ਉਹਨਾਂ ਦੀ ਸ਼ੋਭਾ ਨਹੀਂ ਵਧਦੀ ਪਰ ਕੁਝ ਗੱਲਾਂ ਦੀ ਉਹ ਪਾਲਣਾ ਵੀ ਕਰਦੇ ਹਨ ਅਤੇ ਸਾਡੀਆਂ ਸੱਭਿਆਚਾਰ ਕਦਰਾਂ ਕੀਮਤਾਂ ਢਿੱਲੀ ਪੈ ਰਹੀ ਬਾਰੇ ਸਾਡੀ ਰਾਏ ਇਹ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਪੁਰਾਣੇ ਰਸਮਾਂ ਰੀਤਾਂ ਬਾਰੇ ਕਿ ਉਹ ਪ ਪਹਿਲਾਂ ਆਪਣੇ ਬਚਪਨ ਵਿੱਚ ਕਿਹੜੇ ਕਿਹੜੇ ਰਸਮ ਰਿਵਾਜ ਰੀਤਾਂ ਮਨਾਉਂਦੇ ਸਨ ਅਤੇ ਉਹਨਾਂ ਦੇ ਮਾਪੇ ਤਿਉਹਾਰਾਂ ਵੇਲੇ ਮੇਲਿਆਂ ਵੇਲੇ ਕੀ ਕੀ ਰਸਮਾਂ ਨਿਭਾਉਂਦੇ ਸਨ ਅਤੇ ਪਹਿਲਾਂ ਉਹਨਾਂ ਦਾ ਪਹਿਰਾਵਾ ਕੀ ਸੀ ਅਤੇ ਹੁਣ ਉਹਨਾਂ ਨੂੰ ਇਹ ਗੱਲਾਂ ਸਮਝਾਉਣੀਆਂ ਚਾਹੀਦੀਆਂ ਹਨ ਆਪਣੇ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਵੀ ਇਨ੍ਹਾਂ ਸਭ ਚੀਜ਼ਾਂ ਬਾਰੇ ਜਾਣਕਾਰੀ ਮਿਲੇ ਅਤੇ ਉਹ ਸੱਭਿਆਚਾਰਕ ਰੀਤਾਂ ਦੀ ਸਖਤੀ ਨਾਲ਼ ਪਾਲਣਾ ਕਰੇ